ਜਦੋਂ ਕਿਤੇ ਅਸੀਂ ਆਵਾਜਾਈ ਵਿੱਚ ਜਾਂਦੇ ਹਾਂ ਜਿਵੇਂ ਕਿ ਬੱਸ ਜਾਂ ਟ੍ਰੇਨਾਂ ਤੇ ਇਨ੍ਹਾਂ ਵਿੱਚ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਭੀੜ ਭੜੱਕੇ ਵਿੱਚ ਸਾਨੂੰ ਚੱਕਰ ਆਦਿ ਆ ਜਾਂਦੇ ਹਨ ਅਤੇ ਮਨ ਘਬਰਾਹਟ ਹੋ ਜਾਂਦਾ ਹੈ ਅਤੇ ਆਕਸੀਜਨ ਵੀ ਘੱਟ ਜਾਂਦੀ ਹੈ ਜਿਸ ਨਾਲ਼ ਸਾਡੇ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ਼ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ ਜਿਵੇਂ ਸੜਕ 'ਤੇ ਟੋਏ ਟੱਪੇ ਵਿੱਚੋਂ ਅਸੀਂ ਮੋਟਰਸਾਈਕਲ ਲੰਘਾ ਦਿੰਦੇ ਹਾਂ ਉਸ ਵਿੱਚ ਵੀ ਦੁਰਘਟਨਾ ਹੋਣ ਦਾ ਬਹੁਤ ਚਾਣਸ ਰਹਿੰਦਾ ਹੈ ਇਸ ਵਿੱਚ ਐਕਸੀਰੈਂਟ ਵੀ ਹੋ ਸਕਦਾ ਹੈ ਅਤੇ ਹੋਰ ਵੀ ਨੁਕਸਾਨ ਹੋ ਸਕਦਾ ਹੈ ਅਤੇ ਬੱਸਾਂ ਆਵਾਜਾਈ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਜਿਸ ਵਿੱਚ ਅਸੀਂ ਚੱਕਰ ਖਾ ਕੇ ਵੀ ਗਿਰ ਸਕਦੇ ਹਾਂ ਜਾਂ ਸਾਨੂੰ ਹੋਰ ਵੀ ਕਈ ਤਰ੍ਹਾਂ ਦਾ ਦੌਰਾ ਜਾਂ ਆਦਿ ਘਬਰਾਹਟ ਹੋ ਜਾਂਦੀ ਹੈ ਜਿਸ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਨਾਲ਼ ਸਾਨੂੰ ਆਵਾਜਾਈ ਵਿੱਚ ਘੱਟ ਜਾਣਾ ਚਾਹੀਦਾ ਹੈ